ਸਮੇਂ ਦੇ ਨਾਲ ਪੰਜਾਬੀ ਭਾਸ਼ਾ ਵਿਕਸਿਤ ਹੋਈ ਪਹਿਲਾਂ ਪੰਜਾਬੀ ਇੱਕ ਮੌਖਿਕ ਭਾਸ਼ਾ ਸੀ ਫਿਰ ਗੁਰਮੁਖੀ ਲਿਪੀ ਦਾ ਵਿਕਾਸ ਹੋਇਆ ਜਿਸ ਨਾਲ ਪੰਜਾਬੀ ਨੂੰ ਲਿਖਤ ਰੂਪ ਮਿਲਿਆ ਪੰਜਾਬ ਦੇ ਕੁਝ ਉੱਘੇ ਲੇਖਕ ਅ ਜਿਵੇਂ ਗਿਆਨੀ ਦਿੱਤ ਸਿੰਘ ਭਾਈ ਵੀਰ ਸਿੰਘ ਭਾਈ ਕਾਨ੍ਹ ਸਿੰਘ ਨਾਭਾ ਜਿਹਨਾਂ ਦੁਆਰਾ ਮਹਾਨਕੋਸ਼ ਲਿਖਿਆ ਗਿਆ ਹੈ ਇਹਨਾਂ ਉੱਘੇ ਲੇਖਕਾਂ ਦਾ ਪੰਜਾਬੀ ਭਾਸ਼ਾ ਦੇ ਵਿਕਸਿਤ ਹੋਣ ਵਿੱਚ ਵੱਡਾ ਯੋਗਦਾਨ ਹੈ